ਪੰਜਾਬ ਵਿੱਚ ਜਿਹੜੀ ਮੁੱਖ ਫ਼ਸਲਾਂ ਪੈਦਾ ਹੁੰਦੀਆਂ ਹਨ ਉਹ ਹਨ ਚਾਵਲ ਕਣਕ ਮੱਕੀ ਝੋਨਾ ਕਪਾਹ ਹੈ ਜਿਹੜੀ ਮੁੱਖ ਫ਼ਸਲਾਂ ਜਿਹੜੀਆਂ ਇੱਥੇ ਪੈਦਾ ਹੁੰਦੀਆਂ ਹਨ ਅਤੇ ਜਿਹੜੇ ਪਸ਼ੂ ਪੈਦਾ ਹੁੰਦੇ ਹਨ ਉਹ ਹੈਗੇ ਪੋਲਟਰੀ ਦੇ ਹੈਗੇ ਆ ਗਾਂ ਮੱਝਾਂ ਜੋ ਕਿ ਸਾਡੇ ਹੈ ਪੇਂਡੂ ਖੇਤਰਾਂ ਵਿੱਚ ਅ ਖੇਤੀ ਦੇ ਦੌਰਾਨ ਵੀ ਬਹੁਤ ਜ਼ਿਆਦਾ ਇਸਤੇਮਾਲ ਹੁੰਦੇ ਹੈ ਇਹ ਜਿਹੜੇ ਫ਼ਸਲ ਹੈਗੇ ਹੈ ਮੈਂਗੋ ਅੰਬ ਹੋ ਗਿਆ ਟਮੈਟੋ ਹੋ ਗਿਆ ਲੀਚੀ ਹੋ ਗਈ ਟਮਾਟਰ ਹੋ ਗਿਆ ਇਹ ਸਾਰੀਆਂ ਮਿਲਦੇ ਹਨ ਅਤੇ ਇਹ ਫ਼ਸਲਾਂ ਬਹੁਤ ਹੀ ਜ਼ਿਆਦਾ ਪੰਜਾਬ ਵਿੱਚ ਮੁੱਖ ਫਸਲਾਂ ਹੈਗੀਆਂ ਜਿਹੜੀਆਂ ਬੀਜੀਆਂ ਜਾਂਦੀਆਂ ਹਨ ਅਤੇ ਐਹ ਜਿਹੜੇ ਮੁੱਖ ਪਸ਼ੂ ਹੈਗੇ ਹੈ ਗਾਂ ਅਤੇ ਮੱਝਾਂ ਜਿਹੜੇ ਬਹੁਤ ਹੀ ਇਸਤੇਮਾਲ ਹੁੰਦੇ ਹੈ ਵਿੱਚ ਇਹ ਸਾਰੀਆਂ ਫ਼ਸਲਾਂ ਨੂੰ ਬੁਨਿਆ ਜਾਂਦਾ ਹੈ ਅਤੇ ਇਹਨਾਂ ਦਾ ਟਾਈਮ ਹੁੰਦਾ ਹੈ ਬੁਨਣ ਦਾ ਅਤੇ ਵੱਢਣ ਦਾ ਅਤੇ ਇਹ ਬਹੁਤ ਜ਼ਿਆਦਾ ਖੇਤੀ ਜੋ ਕਿ ਮੇਨਲੀ ਜ਼ਿਆਦਾ ਪੰਜਾਬ ਵਿੱਚ ਹੀ ਹੁੰਦੀ ਹੈ ਅਤੇ ਬਹੁਤ ਤਰੀਕੇ ਨਾਲ ਕੀਤੀ ਜਾਂਦੀ ਹੈ ਇਹ ਮੌਸਮ ਅਤੇ ਸਾਰਾ ਕੁਛ ਵੇਖ ਕੇ ਕੀਤੀ ਜਾਂਦੀ ਹੈ ਅਤੇ ਜਿਹੜੇ ਮੇਨ ਪਸ਼ੂ ਹੈਗੇ ਹੈ ਕੰਮ ਆਉਂਦੇ ਹੈ ਇਹ ਬੀਜਣ ਵਿੱਚ ਇਸਤੇਮਾਲ ਹੁੰਦੇ ਆ ਇਹਨਾਂ ਦੀ ਮਸ਼ੀਨਾਂ ਬਣਾਉਣ ਵਿੱਚ ਅਤੇ ਬਹੁਤ ਜ਼ਿਆਦਾ ਹੈ ਕੰਮ ਕੀਤੇ ਜਾਂਦੇ ਹਨ